ਸਾਡੀ ਜ਼ਿੰਦਗੀ 'ਚ ਦੋ ਤਰੀਕੇ ਦੀਆਂ ਬਿਜਲੀਆਂ ਆਉਂਦੀਆਂ ਨੇ ਜਿਹੜੀਆਂ ਕਿ ਇੱਕ ਆਸਮਾਨੀ ਬਿਜਲੀ ਹੁੰਦੀ ਆ ਇੱਕ ਜਿਹੜੀ ਆਪਾਂ ਘਰੇ ਯੂਜ ਕਰਨ ਵਾਲੀ ਬਿਜਲੀ ਦੀ ਗੱਲ ਕਰਦੇ ਹਾਂ ਜੇ ਆਪਾਂ ਘਰ ਦੇ ਯੂਜ ਕਰਨ ਵਾਲੀ ਬਿਜਲੀ ਦੀ ਗੱਲ ਕਰੀਏ ਉਹ ਭਾਵੇਂ ਹੀ ਘੱਟ ਹੁੰਦੀ ਹੈ ਪਰ ਉਹ ਜਦੋਂ ਝਟਕੇ ਸ ਦੂਜੇ ਨੂੰ ਦਏਗੀ ਅਤੇ ਸਾਨੂੰ ਕੋਈ ਨਾ ਕੋਈ ਪ੍ਰੋਬਲਮ ਦੇ ਸਕਦੀ ਹੈ ਹਰ ਇੱਕ ਚੀਜ਼ ਚੀਜ਼ ਦੀ ਕੋਈ ਲਿਮਿਟ ਹੁੰਦੀ ਆ ਜਿਹਦੇ ਕਰਕੇ ਕਿ ਸਾਨੂੰ ਪ੍ਰੋਬਲਮਾਂ ਆ ਆਉਂਦੀ ਵੀ ਹੈ ਅਤੇ ਜਾਂਦੀ ਵੀ ਹੈ ਅਤੇ ਜੇ ਆਪਾਂ ਆਸਮਾਨੀ ਬਿਜਲੀ ਦੀ ਗੱਲ ਕਰੀਏ ਆਸਮਾਨੀ ਬਿਜਲੀ ਬਾਰੇ ਗੱਲ ਕਰਨ ਦੇ ਕਰਦੇ ਹਾਂ ਅਤੇ ਉਸ ਟਾਈਮ 'ਤੇ ਸ ਕਈ ਵਾਰ ਸਾਡੇ ਘਰਾਂ 'ਚ ਬਿਜਲੀ ਚਲੀ ਜਾਂਦੀ ਹੈ ਜਿਹਦੇ ਕਰਕੇ ਕਿ ਸਾਨੂੰ ਹਾ ਆਪਣੇ ਫੋਨ ਵਗੈਰਾ ਸਭ ਕੁਛ ਬੰਦ ਕਰਨੇ ਪੈਂਦੇ ਆ ਕਿਉਂਕਿ ਜਦੋਂ ਅੱਜ ਕੱਲ੍ਹ ਦੀ ਟੈਕਨੋਲੋਜੀ ਇਹੋ ਜਿਹੀ ਹੈ ਕਿ ਜਿਹੜੀ ਕਿ ਬਿਜਲੀ ਨੂੰ ਗਰੈਬ ਕਰ ਲੈਂਦੀ ਹੈ ਜਿਹਦੇ ਨਾਲ ਗਰੈਬ ਨਹੀਂ ਫੜ ਲੈਂਦੀ ਹੈ ਜਿਹਦੇ ਨਾਲ ਕਿ ਸਾਨੂੰ ਪ੍ਰੋਬਲਮਸ ਹੁੰਦੀਆਂ ਨੇ ਅੱਗੇ ਜਾ ਕੇ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਹੋ ਸਕਦੀ ਹੈ ਕਿਸੇ ਨੂੰ ਹਰ ਇੱਕ ਤਰੀਕੇ ਦੀ ਇੰਟਰਨਲ ਅੰਦਰੂਨੀ ਪ੍ਰੋਬਲਮਾਂ ਹੋ ਸਕਦੀਆਂ ਨੇ ਖਰਾਬੀਆਂ ਹੋ ਸਕਦੀਆਂ ਨੇ ਜਿਹਦੇ ਨਾਲ ਕਿ ਕਿਸੇ ਨੂੰ ਦਿਖਣਾ ਬੰਦ ਹੋ ਸਕਦਾ ਹਰ ਇੱਕ ਤਰੀਕੇ ਦੀ ਪ੍ਰੋਬਲਮ ਨੂੰ ਇਸ ਚੀਜ਼ ਬਾਰੇ ਧਿਆਨ ਰੱਖਣਾ ਪੈਂਦਾ ਜਿਹਦੇ ਨਾਲ ਕਿ ਸਾਨੂੰ ਇੱਕ ਤਾਂ ਸਾਨੂੰ ਇਸ ਚੀਜ਼ ਤੋਂ ਬਚਾਅ ਬਚਣ ਵਾਸਤੇ ਇੱਕ ਤਾਂ ਸਾਨੂੰ ਇਸ ਚੀਜ਼ ਤੋਂ ਬਚਣ ਵਾਸਤੇ ਫੋਨ ਨੂੰ ਬੰਦ ਰੱਖਣੇ ਪੈਣਗੇ ਜੇ ਤਾਂ ਤੁਸੀਂ ਆਸਮਾਨੀ ਬਿਜਲੀ ਦੀ ਗੱਲ ਕਰੋ ਅਤੇ ਜੇ ਤੁਸੀਂ ਦੂਸਰੀ ਘਰ ਦੀ ਬਿਜਲੀ ਦੀ ਗੱਲ ਕਰੋ ਸਾਨੂੰ ਪਲਾਸਟਿਕ ਦੀਆਂ ਚੀਜ਼ਾਂ ਉਸ ਟਾਈਮ 'ਤੇ ਪਾਉਣੀਆਂ ਚਾਹੀਦੀਆਂ ਹਨ ਜਦੋਂ ਆਪਾਂ ਕਿਸੇ ਵੀ ਬਿਜਲੀ ਦੀ ਚੀਜ਼ ਨੂੰ ਹੱਥ ਲਾਵਾਂਗੇ ਨੰਗੇ ਪੈਰੀਂ ਨਹੀਂ ਹੋਣਾ ਹੈਗਾ ਉਸ ਸਮੇਂ ਉਸ ਸਮੇਂ ਸਾਨੂੰ ਦੂਜਿਆਂ ਨੂੰ ਪ੍ਰੋਟੈਕਟ ਕਰਨਾ ਹੈ ਨੰਗੀਆਂ ਤਾਂ ਬੱਚਿਆਂ ਨੂੰ ਉਹਨਾਂ ਚੀਜ਼ਾਂ ਤੋਂ ਦੂਰ ਰੱਖਣਾ ਜਿਹਦੇ ਨਾਲ ਨਿੱਕੇ ਬੱਚਿਆਂ ਨੂੰ ਉਹਨਾਂ ਚੀਜ਼ਾਂ ਤੋਂ ਦੂਰ ਰੱਖਣਾ ਕਿਉਂਕਿ ਉਹਨਾਂ ਨੂੰ ਉਹ ਬਹੁਤ ਹੀ ਨਾਜ਼ੁਕ ਹੁੰਦੇ ਆ ਉਹਨਾਂ ਦੇ ਉਹਨਾਂ ਨਾਲ ਉਸ ਚੀਜ਼ ਨਾਲ ਜਾਨ ਵੀ ਜਾ ਸਕਦੀ ਹੈ